ਹਾਂਜੀ ਮੈਨੂੰ ਸੁਰਜੀਤ ਪਾਤਰ ਪੰਜਾਬੀ ਦਾ ਮਹਾਨ ਕਵੀ ਪਸੰਦ ਹੈ ਉਸ ਦੀਆਂ ਬਹੁਤ ਮਹੱਤਵਪੂਰਨ ਪੁਸਤਕਾਂ ਕਾਵਿ ਸੰਗ੍ਰਹਿ ਹਨ ਹਨੇਰੇ ਵਿੱਚ ਲਟਕਦੀ ਵਰਣਮਾਲਾ ਲਫਜ਼ਾਂ ਦੀ ਦਰਗਾਹ ਪੱਤਝੜ ਦੀ ਪੰਜੇਬ ਸੂਰਜ ਮੰਦਰ ਦੀਆਂ ਪੌੜੀਆਂ ਹਵਾ ਵਿੱਚ ਲਿਖੇ ਹਰਫ਼ ਅਤੇ ਬਿਰਖ ਅਰਜ਼ ਕਰੇ ਅਤੇ ਉਹਨਾਂ ਦੀਆਂ ਇਹਨਾਂ ਪੁਸਤਕਾਂ ਦੀ ਲਿਖਤ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਮੈਨੂੰ ਕਿਉਂ ਪਸੰਦ ਹੈ ਕਿਉਂਕਿ ਉਹਨਾਂ ਨੇ ਸਾਡੇ ਮੌਜੂਦਾ ਸਾਡੇ ਸਮਾਜਿਕ ਸਾਡੇ ਰਾਜਨੀਤਿਕ ਹਾਲਾਤਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਮਨੁੱਖ ਦੀ ਆਪੇ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਸਾਡਾ ਜਿਹੜਾ ਅੱਜ ਦਾ ਮਨੁੱਖ ਹੈ ਉਹਦਾ ਆਪਣਾ ਆਪਾ ਸਾਡੇ ਇਹਨਾਂ ਸਮਾਜਿਕ ਰਾਜਨੀਤਿਕ ਹਾਲਾਤਾਂ ਦੇ ਵਿੱਚ ਗੁਆਚ ਰਿਹਾ ਹੈ ਇਸ ਕਰਕੇ ਹੀ ਮੈਨੂੰ ਉਹ ਲੇਖਕ ਵੀ ਤਾਂ ਹੀ ਇਹ ਪਸੰਦ ਹੈ ਕਿਉਂਕਿ ਇਸਨੇ ਮਨੁੱਖ ਦੀ ਗੱਲ ਕੀਤੀ ਹੈ